ਖੇਡਾਂ ਦਾ ਵਿਕਾਸ ਸਮੇਂ ਦੇ ਨਾਲ ਹੋਇਆ ਹੈ ਮੇਰੀ ਨਜ਼ਰ ਵਿੱਚ ਬਹੁਤ ਵਿਕਾਸ ਹੋਇਆ ਹੈ ਪਹਿਲਾਂ ਜਿਹੜੀਆਂ ਖੇਡਾਂ ਔਰਤਾਂ ਨਹੀਂ ਖੇਡ ਸਕਦੀਆਂ ਸਨ ਉਹਨਾਂ ਖੇਡਾਂ ਵਿੱਚ ਹੁਣ ਔਰਤਾਂ ਵੀ ਵੱਧ ਚੜ੍ਹ ਕੇ ਭਾਗ ਲੈ ਰਹੀਆਂ ਹਨ ਜਿਸ ਤਰ੍ਹਾਂ ਬੋਕਸਿੰਗ ਕੁਸ਼ਤੀ ਇਹਨਾਂ 'ਚ ਔਰਤਾਂ ਨੇ ਵੀ ਆਪਣਾ ਮੁਕਾਮ ਹਾਸਲ ਕੀਤਾ ਹੈ ਕ੍ਰਿਕੇਟ ਜਿਹੜੀ ਹੈ ਉਹ ਪਹਿਲਾਂ ਮਰਦਾਂ ਦੀ ਖੇਡ ਮੰਨੀ ਜਾਂਦੀ ਸੀ ਅੱਜ ਕੱਲ੍ਹ ਔਰਤਾਂ ਵੀ ਉਸ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ ਅਤੇ ਨਾਮ ਕਮਾ ਰਹੀਆਂ ਹਨ ਅੱਗੋਂ ਭਵਿੱਖ ਵਿੱਚ ਵੀ ਇਹ ਲੱਗਦਾ ਹੈ ਕੇ ਇਹਨਾਂ ਦਾ ਰੂਪ ਬਦਲੂਗਾ ਕੇ ਜਿਸ ਤਰ੍ਹਾਂ ਈ ਮੇਲ ਸ਼ੁਰੂ ਹੋਗੀਆਂ ਹਨ ਅਤੇ ਈਸਪੋਟਸ ਵੀ ਸ਼ੁਰੂ ਹੋਣਗੀਆਂ ਜਿਸ ਤਰ੍ਹਾਂ ਕੇ ਨੈੱਟਵਰਕ ਦਾ ਜਮਾਨਾ ਹੈ ਜਤੇ ਭਵਿੱਖ ਵਿੱਚ ਇਹਨਾਂ ਦੀ ਵਿੱਚ ਬਦਲਾਅ ਹੋ ਸਕਦਾ ਹੈ